ਹੈਲੋ ਹਾਂਜੀ ਗੁੱਡ ਆਫਟਰਨੂਨ

ਹਾਜੀ ਹਾਂਜੀ ਮੈਮ ਤੁਸੀਂ ਸਹੀ ਜਗਾ ਫੋਨ ਲਾਇਆ ਮੈਂ ਨਿਤਿਸ਼ ਬੋਲ ਰਿਹਾ ਹੁਸ਼ਿਆਰਪੁਰ ਤੋਂ ਹਾਂਜੀ ਹਾਂਜੀ ਹੁਸ਼ਿਆਰਪੁਰ ਵੈਸੇ ਫੂਡ ਲਈ ਫੇਮਸ ਆ ਜ਼ਿਆਦਾਤਰ ਉੱਥੇ ਫੂਡ ਦੂਰੋਂ ਦੂਰੋਂ ਲੋਕ ਇੱਥੇ ਫੂਡ ਟਰਾਈ ਕਰਨ ਆਉਂਦੇ ਨੇ ਹੁਸ਼ਿਆਰਪੁਰ ਦੇ ਵਿੱਚ ਇੱਕ ਫੂਡ ਸਟੀਟ ਬਣੀ ਹੋਈ ਆ ਉਹ ਬਹੁਤ ਫੇਮਸ ਆ ਉਥੇ ਹਰ ਤਰ੍ਹਾਂ ਦਾ ਫੂਡ ਮਿਲ ਜਾਂਦਾ ਫਾਸਟਫੂਡ ਗੋਲ ਗੱਪੇ ਜਾਂ ਹੋਰ ਕਈ ਆਈਸਕ੍ਰੀਮ ਵਗੈਰਾ ਜੇ ਤੁਸੀਂ ਸਵੀਟ ਸ਼ੋਪ ਵਗੈਰਾ ਜਾਈਆਂ ਚਾਹੀਦੀਆਂ ਤੁਹਾਨੂੰ ਸਵੀਟ ਟਰਾਈ ਕਰਨਾ ਚਾਹੁੰਦੀ ਆ ਤਾਂ ਬਹੁਤ ਵਧੀਆ ਦੁਕਾਨਾਂ ਜਿਵੇਂ ਰਾਮ ਮਸ਼ਹੂਰ ਜ਼ਿਲ੍ਹੇ ਕੀ ਕੰਦੀ ਪਹਿਲਵਾਨ ਇਦਾਂ ਦੀਆਂ ਸ਼ੌਪਸ ਨੇ ਰਾਮ ਜਿਹੜੀ ਆ ਦੀ ਦੁਕਾਨ ਜਿਹੜੀ ਆ ਵਿੱਚ ਫੈਸ਼ਨ ਚੋਂਕ ਦੇ ਬਹੁਤ ਮਸ਼ਹੂਰ ਆ ਇੱਥੇ ਤੁਸੀਂ ਜਾ ਸਕਦੇ ਆ ਟ੍ਰਾਈ ਕਰ ਸਕਦੇ ਆ ਫਾਸਟਫੂਡ ਲਈ ਤੁਸੀਂ ਲਵਲੀ ਫਾਸਟਫੂਡ ਜਾ ਸਕਦੇ ਆ ਜਾਂ ਇੱਥੇ ਸ਼ਿਮਲਾ ਪਹਾੜੀ ਅੰਬਾਰਾ ਤੁਸੀਂ ਜਾ ਸਕਦੇ ਆ ਬਰਗਰ ਜੇ ਤੁਸੀਂ ਟਰਾਈ ਕਰਨਾ ਤਾਂ ਤੁਸੀਂ ਬਰਗਰ ਚਾਚੂ ਦਾ ਬਰਗਰ ਟਰਾਈ ਕਰ ਕਰ ਸਕਦੇ ਆ ਉਹ ਸਿਟੀ ਸੈਂਟਰ ਦੇ ਕੋਲ ਆ ਬਸ ਸਟੈਂਡ ਕੋਲ ਤੁਸੀਂ ਜਾਓ ਉੱਤੇ ਤੁਹਾਨੂੰ ਮਿਲਜੁਗਾ ਉਹ ਬੈਸਟ ਬਰਗਰ ਮੰਨਿਆ ਗਿਆ ਉੱਥੇ ਪਨੀਰ ਟਿੱਕਾ ਮਸ਼ਰੂਮ ਟਿੱਕਾ ਉਹੀ ਮੈਂ ਤੁਹਾਨੂੰ ਦੱਸਿਆ ਕਿ ਫੂਡ ਸਟੀਟ ਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਸਟੋਲ ਲੱਗੇ ਹੁੰਦੇ ਉਹ ਬਹੁਤ ਫੇਮਸ ਆ ਉੱਥੇ ਹਰ ਤਰਾਂ ਦਾ ਫੂਡ ਵੀ ਮਿਲ ਜਾਂਦਾ ਆ ਪਨੀਰ ਟਿੱਕਾ ਤਾਂ ਸਪੈਸ਼ਲੀ ਬਹੁਤ ਵਧੀਆ ਬਣਾਉਂਦੇ ਉੱਥੇ ਤੁਸੀਂ ਟ੍ਰਾਈ ਕਰ ਸਕਦੇ ਆ ਉੱਥੇ ਹੋਰ ਮੈਂ ਤੁਹਾਨੂੰ ਚਾਟ ਪਾਪੜੀ ਜਾਂ ਗੋਲ ਗੱਪੇ ਸਜੈਸਟ ਕਰ ਸਕਦਾ ਉਹਦੇ ਲਈ ਤੁਸੀਂ ਬੰਗਾਲੀ ਜਾ ਸਕਦੇ ਆ ਬੰਗਾਲੀ ਦੀ ਸ਼ਾਪ ਆ ਉਹ ਨੇੜੇ ਬੱਸ ਸਟੈਂਡ ਆ ਉਹ ਵੀ ਬਹੁਤ ਮਸ਼ਹੂਰ ਆ ਹੁਸ਼ਿਆਰਪੁਰ ਦੇ ਵਿੱਚ ਜੇ ਤੁਸੀਂ ਬਾਕੀ ਜੇ ਕੋਈ ਬ੍ਰੇਕਫਾਸਟ ਡਿਨਰ ਜਾਂ ਲੰਚ ਕਰਨਾ ਤਾਂ ਵਿੱਚ ਪੁਰਾਣੀਆਂ ਕਚਹਿਰੀਆਂ ਕੋਲ ਟਰਾਈ ਕਰ ਸਕਦੇ ਆ ਵੈਸ਼ਨੋ ਢਾਬਾ ਉੱਥੇ ਬਹੁਤ ਵਧੀਆ ਫੂਡ ਮਿਲਦਾ ਹਰ ਤਰ੍ਹਾਂ ਦੀ ਸਬਜ਼ੀ ਰੋਟੀ ਮਿਲ ਜਾਂਦੀ ਹੈ ਉੱਥੇ ਜੇ ਤੁਸੀਂ ਜੂਸ ਵਗੈਰਾ ਪੀਣਾ ਜਾਂ ਡਰਿੰਕਸ ਟਰਾਈ ਕਰਨੀ ਆ ਕੋਈ ਤਾਂ ਸੈਸ਼ਨ ਚੋਕ ਤੁਹਾਨੂੰ ਨਾਰੰਗ ਕੈਫਟੇਰੀ ਮਿਲ ਜਾਊਗਾ ਉਥੇ ਹਰ ਤਰਾਂ ਦੀ ਜੂਸ ਜਾਂ ਸ਼ੇਕਸ ਵਗੈਰਾ ਮਿਲ ਜਾਣਗੇ ਤੁਹਾਨੂੰ ਪੀਣ ਲਈ ਅਤੇ ਸਵੀਟ ਲਈ ਮੈਂ ਤੁਹਾਨੂੰ ਦੱਸਿਆ ਕਿ ਉਹ ਕੰਦੀ ਪਹਿਲਵਾਨ ਅਤੇ ਰਾਮ ਬਹੁਤ ਮਸ਼ਹੂਰ ਨੇ ਦੋਨੋਂ ਬਹੁਤ ਵਧੀਆ ਬਣਾਉਂਦੇ ਨੇ ਵੈਸੇ ਤਾਂ ਇੱਦਾਂ ਦੀ ਕੋਈ ਜਗ੍ਹਾ ਹੈ ਨਹੀਂ ਜੀ ਜ਼ਿਆਦਾ ਖ਼ਰਾਬ ਬਣਾਉਂਦੇ ਹੋਣ ਜਾਂ ਸਾਰੇ ਵਧੀਆ ਹੀ ਆ ਵੈਸੇ ਪਰ ਕੋਸ਼ਿਸ਼ ਕਰਨਾ ਜਿੱਦਾਂ ਕਿ ਇਧਰ ਪੂਲ ਟਾਈਮ ਵੱਲ ਕੁਛ ਸਟੋਲ ਲੱਗਦੇ ਆ ਉਥੇ ਇੰਨਾ ਵਧੀਆ ਨਹੀਂ ਬਣਾਉਂਦੇ ਉਹ ਅਤੇ ਹਾਈਜੀਨ ਵੀ ਨਾ ਸਫ਼ਾਈ ਨਹੀਂ ਹੁੰਦੀ ਉੱਥੇ ਬਸ ਬਾਕੀ ਦਾ ਠੀਕ ਹੁੰਦਾ ਫੂਡ ਸਟੀਟ ਸਪੈਸ਼ਲੀ ਉਥੇ ਸਭ ਤੋਂ ਜ਼ਿਆਦਾ ਸਾਫ਼ ਅਤੇ ਹਾਈਜੀਨਿਕ ਫੂਡ ਮਿਲਦਾ ਤੁਸੀਂ ਟ੍ਰਾਈ ਕਰ ਸਕਦੇ ਪੀਜ਼ਾ ਲਈ ਤੁਸੀਂ ਵੈਸੇ ਤਾਂ ਡੋਮੀਨੋਜ ਪੀਜਾ ਵੀ ਹੈ ਇੱਥੇ ਤਾਂ ਹਰ ਤਰ੍ਹਾਂ ਦੇ ਕੇ ਐਫ ਸੀ ਵੀ ਆ ਬਰਗਰ ਕਿੰਗ ਵੀ ਆ ਪਰ ਜੇ ਤੁਸੀਂ ਸਪੈਸ਼ਲੀ ਜਾਣਾ ਤਾਂ ਮੈਂ ਤੁਹਾਨੂੰ ਦੱਸਿਆ ਨਾਰੰਗ ਕੈਫੇਟੇਰੀਆ ਉਹ ਬਹੁਤ ਵਧੀਆ ਹਰ ਤਰ੍ਹਾਂ ਮਿਲ ਜਾਂਦੀ ਹੈ ਵੈਸੇ ਫਾਸਟਫੂਡ ਦੇ ਵਿੱਚ ਉਹਦੇ ਹੀ ਓਪੋਜਿਟ ਇੱਕ ਐਮ ਸੀ ਐਮ ਵੀ ਆ ਉੱਥੇ ਵੀ ਤੁਸੀਂ ਜਾ ਸਕਦੇ ਆ ਟ੍ਰਾਈ ਕਰ ਸਕਦੇ ਹਾਂ ਪੀਜਾ ਲਈ ਬਸ ਸੁਜੈਸ਼ਨ ਤਾਂ ਮੈਂ ਦੇ ਦਿੱਤੀਆਂ ਸਪੈਸ਼ਨ ਓਕੇ ਥੈਂਕ ਯੂ ਓਕੇ ਵੈਲਕਮ